ਸਵੇਰੇ ਉੱਠ ਕੇ ਨਿੰਬੂ ਪਾਣੀ ਪੀਓ ਅਜਵਾਇਣ ਦਾ ਪਾਣੀ ਪੀਣਾ ਚਾਹੀਦਾ ਹੈ ਸੌਂਫ ਦਾ ਪਾਣੀ ਪੀਣਾ ਚਾਹੀਦਾ ਹੈ ਸ਼ਹਿਦ ਵਾਲਾ ਕੋਸਾ ਪਾਣੀ ਪੀਣਾ ਚਾਹੀਦਾ ਹੈ ਖੁਸ਼ਕ ਰੋਟੀ ਖਾਣੀ ਚਾਹੀਦੀ ਹੈ ਬਿਨਾਂ ਘਿਓ ਦੀ ਸਬਜ਼ੀ ਠੀਕ ਰਹਿੰਦੀ ਹੈ ਰਾਤ ਨੂੰ ਭਾਰਾ ਭੋਜਨ ਨਾ ਖਾਓ ਰਾਤ ਨੂੰ ਦੁੱਧ ਵੀ ਨਾ ਪੀਓ